ਹੈਲੋ ਕੀ ਤੁਸੀਂ ਮੀਸ਼ੋ ਤੋਂ ਬੋਲ ਰਹੇ ਹੋ ਹਾਂਜੀ ਮੈਂ ਨਾ ਤੁਹਾਡੇ ਐਪ ਤੋਂ ਤਿੰਨ ਦਿਨ ਪਹਿਲਾਂ ਇਹ ਸ਼ਰਟ ਔਡਰ ਕੀਤੀ ਸੀ ਜੋ ਕਿ ਮੈਨੂੰ ਕੱਲ੍ਹ ਡਿਲੀਵਰ ਹੋਈ ਹੈ ਔਰ ਮੈਂ ਉਹ ਸ਼ਰਟ ਕੱਲ੍ਹ ਦੇਖੀ ਹੈ ਉਹ ਬਹੁਤ ਹੀ ਜ਼ਿਆਦਾ ਬੇਕਾਰ ਮਟੀਰੀਅਲ ਹੈ ਜੋ ਕਿ ਮੈਂ ਜਿਸ ਮਟੀਰੀਅਲ ਦੀ ਸ਼ਰਟ ਔਡਰ ਕੀਤੀ ਸੀ ਉਹ ਤਾਂ ਬਿਲਕੁਲ ਹੀ ਨਹੀਂ ਹੈ ਔਰ ਉਹਦੀ ਫੀਟਿੰਗ ਵੀ ਬਹੁਤ ਜ਼ਿਆਦਾ ਲੂਜ ਹੈ ਮੈਂ ਜੋ ਸਾਈਜ਼ ਦਿੱਤਾ ਸੀ ਵਿੱਚ ਉਹ ਤਾਂ ਬਿਲਕੁਲ ਹੀ ਨਹੀਂ ਹੈ ਉਹਦੇ ਓਪੋਜਿਟ ਆਇਆ ਹੈ ਔਰ ਮੈਂ ਪਹਿਨ ਕੇ ਦੇਖਿਆ ਫਿਰ ਮੈਂ ਸੋਚਿਆ ਇੱਕ ਵਾਰ ਕਿ ਚਲੋ ਕੋਈ ਗੱਲ ਨਹੀਂ ਅਗਰ ਲੂਜ਼ ਆ ਤਾਂ ਮੈਂ ਥੋੜ੍ਹਾ ਚਿਰ ਪਾ ਕੇ ਦੇਖ ਲੈਂਦੀ ਹਾਂ ਲੂਜ ਦਾ ਵੀ ਟਰੈਂਡ ਚੱਲ ਰਿਹਾ ਬਟ ਉਸ ਤੋਂ ਬਾਅਦ ਇੱਕ ਦਿਨ ਬਾਅਦ ਜਦੋਂ ਮੈਂ ਉਸ ਨੂੰ ਵੋਸ਼ ਕੀਤਾ ਤਾਂ ਉਸਦਾ ਤਾਂ ਸਾਰਾ ਹੀ ਕਲਰ ਨਿਕਲ ਗਿਆ ਜੋ ਕਿ ਮੇਰੇ ਬਿਲਕੁਲ ਵੀ ਯੂਜ ਵਿੱਚ ਨਹੀਂ ਆ ਰਹੀ ਹੁਣ ਔਰ ਪ੍ਰੋਡਕਟ ਦੀ ਮੈਂ ਹਾਲਤ ਦੇਖੀ ਹੈ ਅਤੇ ਮੈਂ ਉਸ ਤੋਂ ਬਾਅਦ ਉਸਨੂੰ ਚੈੱਕ ਕੀਤਾ ਤਾਂ ਇੱਕ ਦੋ ਜਗ੍ਹਾ 'ਤੇ ਕੱਟ ਵੀ ਲੱਗੇ ਹੋਏ ਸਨ ਜੋ ਕਿ ਫਟੀ ਹੋਈ ਸੀ ਦੋ ਕੁ ਜਗ੍ਹਾ ਤੋਂ ਅਤੇ ਮੇਰੇ ਤਾਂ ਸਾਰੇ ਪੈਸੇ ਵੇਸਟ ਹੋ ਗਏ ਮੈਂ ਤਾਂ ਤੁਹਾਡੇ ਕੋਲੋਂ ਪ੍ਰੋਡਕਟ ਮੰਗਵਾ ਕੇ ਬਹੁਤ ਜ਼ਿਆਦਾ ਪਛਤਾਉਂਦੀ ਪਈ ਹਾਂ ਮੇਰੇ ਸਾਰੇ ਪੈਸੇ ਵੀ ਵੇਸਟ ਹੋ ਗਏ ਨੇ ਔਰ ਮੈਨੂੰ ਪ੍ਰੋਡਕਟ ਵੀ ਕੁਛ ਵਧੀਆ ਨਹੀਂ ਮਿਲਿਆ ਸੋ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਮੈਨ ਮੈਨੂੰ ਤਾਂ ਮੇਰਾ ਪ੍ਰੋਡਕਟ ਤੁਸੀਂ ਰਿਟਰਨ ਕਰ ਲਓ ਔਰ ਮੇਰੇ ਪੈਸੇ ਮੈਨੂੰ ਵਾਪਸ ਦੇ ਦਿੱਤੇ ਜਾਣ